ਜੀ ਹਾਂ ਸਾਡੇ ਪਿੰਡਾਂ ਦੇ ਨੌਜਵਾਨਾਂ ਵਿੱਚ ਲੋਕ ਨਾਚ ਪ੍ਰਤੀ ਬਹੁਤ ਦਿਲਚਸਪੀ ਦੇਖੀ ਜਾ ਸਕਦੀ ਹੈ ਹਾਲ ਦੇ ਸਮੇਂ ਵਿੱਚ ਨੌਜਵਾਨਾਂ ਵੱਲੋਂ ਲੋਕ ਨਾਚਾਂ ਦੇ ਸਮੂਹ ਬਣਾਏ ਜਾਂਦੇ ਹਨ ਜਿਹਨਾਂ ਨੂੰ ਮਲਵਈ ਗਿੱਧੇ ਦੇ ਗਰੁੱਪ ਕਿਹਾ ਜਾਂਦਾ ਹੈ ਜੋ ਕਿ ਵਿਆਹ ਸ਼ਾਦੀਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਜਿਸ ਨਾਲ ਲੋਕਾਂ ਦਾ ਮਨੋਰੰਜਨ ਵੀ ਹੁੰਦਾ ਹੈ ਅਤੇ ਉਹਨਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਅਤੇ ਨਾਲ ਹੀ ਕਲਾ ਦੀ ਵੀ ਮਹੱਤਤਾ ਵੱਧਦੀ ਹੈ ਇਹਨਾਂ ਸਮੂਹਾਂ ਵਿੱਚ ਇਕੱਲੇ ਮੁੰਡੇ ਜਾਂ ਫਿਰ ਇਕੱਲੀਆਂ ਕੁੜੀਆਂ ਹੋ ਸਕਦੀਆਂ ਹਨ ਜਾਂ ਫਿਰ ਸਾਂਝੇ ਰੂਪ ਵਿੱਚ ਇਹ ਗਰੁੱਪ ਹੋ ਸਕਦੇ ਹਨ ਅਤੇ ਇਹਨਾਂ ਦਾ ਪਹਿਰਾਵਾ ਵੀ ਸੱਭਿਆਚਾਰਕ ਹੁੰਦਾ ਹੈ ਜੋ ਕਿ ਲੋਕ ਨਾਚਾਂ ਦੀ ਇੱਕ ਖ਼ਾਸ ਪਹਿਚਾਣ ਹੈ ਇਸ ਤੋਂ ਇਲਾਵਾ ਕਾਲਜਾਂ ਯੂਨੀਵਰਸਿਟੀਆਂ ਵਿੱਚ ਮੁਕਾਬਲੇ ਦੇ ਰੂਪ ਵਿੱਚ ਵੀ ਲੋਕ ਨਾਚਾਂ ਦਾ ਪ੍ਰਦਰਸ਼ਨ ਨੌਜਵਾਨਾਂ ਦੁਆਰਾ ਵੱਧ ਚੜ੍ਹ ਕੇ ਕੀਤਾ ਜਾਂਦਾ ਹੈ